ਮੈਨੂੰ ਡਾਂਸ ਨਾਲ ਬਹੁਤ ਪਿਆਰ ਹੈ ਤੇ ਮੈਂ ਸੋਚਦੀ ਹਾਂ ਕਿ ਇੱਕ ਦਿਨ ਵਧੀਆ ਡਾਂਸਰ ਬਣ ਜਾਵਾਂਗੀ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਡਾਂਸ ਸਕਿਲ ਨੂੰ ਹੋਰ ਵਧਾਵਾਂ ਨਵੇਂ ਨਵੇਂ ਸਟਾਈਲ ਸਿੱਖਾਂ ਅਤੇ ਆਪਣੇ ਡਾਂਸ ਨਾਲ ਲੋਕਾਂ ਨੂੰ ਉਤਸ਼ਾਹਿਤ ਕਰ ਸਕਾਂ ਮੇਰਾ ਡਾਂਸ ਸਿਰਫ ਮੇਰੇ ਲਈ ਸ਼ੌਕ ਹੀ ਨਹੀਂ ਬਲਕਿ ਮੇਰੀ ਜ਼ਿੰਦਗੀ ਦਾ ਵੀ ਹਿੱਸਾ ਹੈ ਕਿਉਂਕਿ ਇਸ ਵਿੱਚ ਮੈਂ ਆਪਣੇ ਭਾਵਾਂ ਨੂੰ ਪ੍ਰਗਟ ਕੀਤਾ ਹੈ ਮੈਂ ਆਪਣੇ ਡਾਂਸ ਨੂੰ ਕਿਸੇ ਹੋਰ ਵੱਡੇ ਪਲੇਟਫਾਰਮ 'ਤੇ ਲੈ ਕੇ ਜਾਣਾ ਚਾਹੁੰਦੀ ਹਾਂ ਜਿੱਥੇ ਮੈਂ ਆਪਣੀ ਸਕਿਲਸ ਨੂੰ ਪ੍ਰਗਟ ਕਰ ਸਕਾਂ ਅਤੇ ਲੋਕਾਂ ਨੂੰ ਉਤਸ਼ਾਹਿਤ ਕਰ ਸਕਾਂ ਜਿਵੇਂ ਕਿ ਹਿਪ ਹੋਪ ਅਤੇ ਕਲਾਸਿਕ ਡਾਂਸ ਵਿੱਚ ਮੇਰਾ ਬਹੁਤ ਹੀ ਉਤਸ਼ਾਹ ਹੈ ਮੈਂ ਆਪਣੇ ਇਸ ਸੁਪਨੇ ਵਿੱਚ ਇੱਕ ਵੱਡਾ ਸੁਪਨਾ ਇਹ ਵੇਖਿਆ ਹੈ ਕਿ ਇੱਕ ਮੈਂ ਕਿਸੇ ਵੱਡੇ ਪਲੇਟਫੋਮ ਵਿੱਚ ਜਾ ਕੇ ਹਿੱਸਾ ਲੈਣਾ ਚਾਹੁੰਦੀ ਹਾਂ ਜਿਵੇਂ ਕਿ ਡਾਂਸ ਇੰਡੀਆ ਡਾਂਸ ਇਸ ਲਈ ਮੈਂ ਡਾਂਸ ਕਲਾਸਾਂ ਵਿੱਚ ਨਵੇਂ ਤਰੀਕੇ ਅਤੇ ਢੰਗ ਵੀ ਸਿੱਖਣਾ ਚਾਹੁੰਦੀ ਹਾਂ ਜਿਸ ਨਾਲ ਮੈਂ ਆਪਣੇ ਆਪ ਵਿੱਚ ਇਮਪਰੂਵ ਹੋ ਸਕਾਂ ਜਿਸ ਨਾਲ ਲੋਕਾਂ ਨੂੰ ਵੀ ਉਤਸ਼ਾਹਿਤ ਕਰ ਸਕਾਂ ਇਸ ਤੋਂ ਬਿਨਾਂ ਡਾਂਸ ਨਾਲ ਸੰਬੰਧਿਤ ਮੇਰੇ ਹੋਰ ਵੀ ਸੁਪਨੇ ਹਨ ਜਿਹਨਾਂ ਵਿੱਚ ਮੇਰਾ ਇੱਕ ਵੱਡਾ ਸੁਪਨਾ ਕਿਸੇ ਡਾਂਸ ਪ੍ਰੋਫੈਸ਼ਨ ਵਿੱਚ ਬਣ ਕੇ ਜਾਂ ਇਸ ਨੂੰ ਅੱਗੇ ਲਿਜਾ ਕੇ ਕਿਸੇ ਕੋਈ ਵੀ ਅਕੈਡਮੀ ਖੋਲ੍ਹ ਸਕਾਂ ਅਤੇ ਨਵੇਂ ਨਵੇਂ ਡਾਂਸਰਾਂ ਨੂੰ ਨਵੇਂ ਤਰੀਕਿਆਂ ਨਾਲ ਟ੍ਰੇਨਿੰਗ ਟ੍ਰੇਨ ਕਰ ਸਕਾਂ ਮੈਨੂੰ ਲੱਗਦਾ ਹੈ ਕਿ ਡਾਂਸ ਸਿਰਫ ਇੱਕ ਕਲਾ ਹੀ ਨਹੀਂ ਬਲਕਿ ਸਾਰੇ ਭਾਵਾਂ ਲੋਕਾਂ ਦੇ ਭਾਵਾਂ ਨੂੰ ਪ੍ਰਗਟ ਕਰਨ ਦਾ ਵੀ ਇੱਕ ਤਰੀਕਾ ਹੈ ਇਸ ਵਿੱਚ ਲੋਕਾਂ ਦੇ ਭਾਵ ਪ੍ਰਗਟ ਹੁੰਦੇ ਹਨ

ਆਪਣੀ ਇੱਕ ਕਮੈਟੀ ਵੀ ਬਣਾਵਾਂਗੇ ਅਤੇ ਜਿੱਥੇ ਲੋਕ ਆਪਣੇ ਡਾਂਸ ਦੇ ਆਧਾਰ 'ਤੇ ਆਪਣੇ ਆਪ ਨੂੰ ਪ੍ਰਦਰਸ਼ਿਤ ਕਰ ਸਕਣ ਲੋਕਾਂ ਨੂੰ ਉਤਸ਼ਾਹਿਤ ਕਰ ਸਕਣ ਅਤੇ ਮੈਂ ਆਪਣੇ ਸੁਪਨਾ ਪੂਰੇ ਅਤੇ ਮੈਨੂੰ ਉਮੀਦ ਵੀ ਹੈ ਕਿ ਮੈਂ ਇਹ ਆਪਣਾ ਸੁਪਨਾ

ਮੇਰੀ ਜ਼ਿੰਦਗੀ ਵੀ ਹੈ ਅਤੇ ਇਸ ਦੇ ਨਾਲ ਨਾਲ ਡਾਂਸ ਮੇਰੇ ਲਈ ਇੱਕ ਸਫਰ ਹੈ ਅਤੇ ਮੈਂ ਇਸ ਦਾ ਹਰ ਇੱਕ ਕਦਮ 'ਤੇ ਆਨੰਦ ਲੈਣਾ ਚਾਹੁੰਦੀ ਹਾਂ